ਦੌੜਨ ਦਾ ਮੇਰਾ ਟੀਚਾ ਇਹੀ ਆ ਮੇਨ ਤਾਂ ਇਹ ਆ ਕਿ ਉਹਦੇ ਨਾਲ ਸਟ੍ਰੈਂਥ ਬਣੀ ਰਹਿੰਦੀ ਹੈ ਬੰਦੇ ਦਾ ਮਾਇੰਡ ਸੈਟਅੱਪ ਵਧੀਆ ਰਹਿੰਦਾ ਅਤੇ ਬੌਡੀ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਬੌਡੀ ਵਧੀਆ ਸ਼ੇਪ 'ਚ ਰਹਿੰਦੀ ਹੈ ਅਤੇ ਬੰਦੇ 'ਤੇ ਮੋਟਾਪਾ ਨਹੀਂ ਆਉਂਦਾ ਅਤੇ ਇਹਦੇ 'ਚ ਸ਼ੌਕ ਅਤੇ ਮੇਰੀ ਪ੍ਰਾਪਤੀ ਇਹੀ ਆ ਕਿ ਮੈਂ ਆਰਮੀ 'ਚ ਜਾਣਾ ਚਾਹੁੰਦਾ ਅਤੇ ਆਰਮੀ 'ਚ ਜਾ ਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਅਤੇ ਜਿੰਨੀ ਵਧੀਆ ਰਨਿੰਗ ਹੋਊਗੀ ਉਨਾ ਹੀ ਮੈਨੂੰ ਰਨਿੰਗ ਫੌਜ ਦੇ ਗਰਾਊਂਡ 'ਚ ਸੌਖਾ ਹੋਊਗਾ ਅਤੇ ਉਨਾ ਹੀ ਮੇਰੇ ਪੁਆਇੰਟ ਵਧੀਆ ਆਉਣਗੇ ਬਾਕੀ ਇਹਦੇ ਨਾਲ ਮਾਇੰਡ ਸੈਟਅੱਪ ਸਭ ਤੋਂ ਮੇਨ ਗੱਲ ਹੈ ਕਿ ਮਾਇੰਡ ਸੈਟਅੱਪ ਰਹਿੰਦਾ ਵਧੀਆ ਅਤੇ ਬੌਡੀ ਸਟ੍ਰਕਚਰ ਸਭ ਤੋਂ ਵਧੀਆ ਰਹਿੰਦਾ ਬੰਦਾ ਮੋਟਾ ਨਹੀਂ ਹੁੰਦਾ ਬਿਮਾਰੀਆਂ ਨਹੀਂ ਲੱਗਦੀਆਂ ਇਹੀ ਮੇਨ ਰੀਜ਼ਨ ਹੈ ਰਨਿੰਗ ਦਾ ਤਾਂ ਮੇਰਾ